ਸਕੂਲ ਦੌਰਾਨ ਡਾਂਸ ਅਤੇ ਸ਼ੈਲੀ ਸਿੱਖਣ ਅਤੇ ਇਸਨੂੰ ਪ੍ਰਦਰਸ਼ਨ ਕਰਨ ਦੇ ਮੈਨੂੰ ਬਹੁਤ ਸਾਰੇ ਮੌਕੇ ਮਿਲਦੇ ਸੀ ਅਤੇ ਇੱਕ ਵਾਰ ਮੈਨੂੰ ਮੇਰੇ ਟੀਚਰਾਂ ਅਤੇ ਮੇਰੇ ਦੋਸਤਾਂ ਨੇ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ ਕਿ ਮੈਂ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਵਾਂ ਅਤੇ ਉਹਨਾਂ ਦੇ ਬਹੁਤ ਜ਼ਿਆਦਾ ਕਹਿਣ 'ਤੇ ਮੈਂ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਲਈ ਤਿਆਰ ਹੋ ਗਈ ਅਤੇ ਜਦੋਂ ਇਸ ਮੁਕਾਬਲੇ ਲਈ ਮੈਨੂੰ ਬਹੁਤ ਜ਼ਿਆਦਾ ਤਿਆਰੀ ਕਰਨੀ ਪਈ ਅਤੇ ਮੈਂ ਥੱਕ ਜਾਂਦੀ ਸੀ ਅਤੇ ਮੈਨੂੰ ਬਹੁਤ ਗੁੱਸਾ ਚੜ੍ਹਦਾ ਸੀ ਕਿ ਮੈਂ ਇਸ ਮੁਕਾਬਲੇ ਲਈ ਹਾਂ ਕਿਉਂ ਕੀਤੀ ਪਰ ਹੌਲੀ ਹੌਲੀ ਜਦੋਂ ਮੈਂ ਇਸਨੂੰ ਸਿੱਖਿਆ ਤਾਂ ਮੈਨੂੰ ਇਹ ਵਧੀਆ ਲੱਗਣ ਲੱਗ ਗਿਆ ਅਤੇ ਜਦੋਂ ਮੈਂ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੀ ਸੀ ਤਾਂ ਜਦੋਂ ਮੇਰਾ ਇਹ ਮੁਕਾਬਲਾ ਹੋਇਆ ਤਾਂ ਸਟੇਜ਼ 'ਤੇ ਜਦੋਂ ਮੇਰਾ ਡਾਂਸ ਕੰਪਲੀਟ ਹੋਇਆ ਤਾਂ ਸਾਰੀ ਔਡੀਅੰਸ ਖੜ੍ਹੇ ਹੋ ਕੇ ਤਾੜੀਆਂ ਪਾ ਰਹੇ ਸੀ ਉਸ ਵਕਤ ਮੈਨੂੰ ਆਪਦੇ ਆਪ ਨੇ ਬਹੁਤ ਮਾਣ ਮਹਿਸੂਸ ਹੋਇਆ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ 'ਚ ਮੈਨੂੰ ਸਾਰਿਆਂ ਤੋਂ ਵਧੀਆ ਸਾਰਿਆਂ ਵਿੱਚੋਂ ਪਹਿਲੇ ਨੰਬਰ 'ਤੇ ਕੱਢਿਆ ਗਿਆ ਅਤੇ ਮੈਨੂੰ ਸਨਮਾਨਿਤ ਕੀਤਾ ਗਿਆ ਅਤੇ ਉਦੋਂ ਤੋਂ ਹੀ ਮੈਂ ਹਰ ਮੁਕਾਬਲੇ ਦੇ ਵਿੱਚ ਹਿੱਸਾ ਲੈਂਦੀ ਹਾਂ ਅਤੇ